ਜਿਵੇਂ ਕਿ ਮੈਨੂੰ ਛੋਟੇ ਹੁੰਦੇ ਤੋਂ ਹੀ ਕਾਫ਼ੀ ਸ਼ੌਂਕ ਸੀ ਘੁੰਮਣ ਫਿਰਨ ਦਾ ਅਤੇ ਅਕਸਰ ਮੈਂ ਘੁੰਮਦਾ ਫਿਰਦਾ ਰਹਿੰਦਾ ਅਤੇ ਅਕਸਰ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਕਿਤੇ ਨਾ ਕਿਤੇ ਘੁੰਮਦਾ ਫਿਰਦਾ ਰਹਿੰਦਾ ਸੀਗਾ ਅਤੇ ਇੱਕ ਵਾਰ ਆਪਾਂ ਸਾਰੇ ਦੋਸਤ ਇਕੱਠੇ ਹੋ ਕੇ ਸ਼ਿਮਲੇ ਗਏ ਹੋਏ ਸੀਗੇ ਅਤੇ ਉੱਥੇ ਉੱਥੇ ਕਾਫ਼ੀ ਸੋਹਣੀ ਇਹ ਪਹਾੜ ਕਾਫ਼ੀ ਸੋਹਣੀਆਂ ਸਿਨਰੀਆਂ ਸੀਗੀਆਂ ਅਤੇ ਕਾਫ਼ੀ ਬੂਟੇ ਸੀਗੇ ਅਤੇ ਉਹ ਕਾਫ਼ੀ ਜ਼ਿਆਦਾ ਹੀ ਸੋਹਣਾ ਉੱਥੇ ਦ੍ਰਿਸ਼ ਦਿਖਦਾ ਸੀਗਾ ਅਤੇ ਮੈਂ ਆਪਣੇ ਫੋਨ ਵਿੱਚ ਪਹਿਲੀ ਵਾਰ ਉੱਥੇ ਫੋਟੋ ਖਿੱਚ ਲਈ ਅਤੇ ਉਹ ਫੋਟੋ ਬਹੁਤ ਜ਼ਿਆਦਾ ਸੋਹਣੀ ਆਈ ਅਤੇ ਉਹ ਫੋਟੋ ਵਧੀਆ ਲੱਗੀ ਸਾਰੇ ਮੇਰੇ ਯਾਰ ਦੋਸਤਾਂ ਨੂੰ ਅਤੇ ਉਹ ਮੈਂ ਫੋਟੋ ਆਪਣੀ ਕਾਫ਼ੀ ਰਿਸ਼ਤੇਦਾਰਾਂ ਨੂੰ ਭੇਜੀ ਵੀ ਕਿ ਦੱਸਣ ਲਈ ਕਿ ਹਾਂ ਮੈਂ ਗਿਆ ਹੋਇਆ ਸੀਗਾ ਅਤੇ ਉਹ ਉਹ ਫੋਟੋ ਮੇਰੀ ਜ਼ਿੰਦਗੀ ਦੀ ਪਹਿਲੀ ਫੋਟੋ ਸੀਗੀ ਅਤੇ ਉਸ ਉਸ ਟਾਈਮ ਮੇਰੀ ਉਮਰ ਅਠਾਰਾਂ ਕੁ ਸਾਲ ਦੀ ਹੋਣੀ ਹੈ ਅਤੇ ਉਸ ਟਾਈਮ ਮੈਂ ਪਹਿਲੀ ਵਾਰ ਫੋਟੋ ਖਿੱਚੀ ਸੀਗੀ ਅਤੇ ਉਹ ਫੋਟੋ ਸਾਰੇ ਮੇਰੇ ਯਾਰਾਂ ਦੋਸਤ ਨੂੰ ਸਾਰੇ ਮੇਰੇ ਰਿਸ਼ਤੇਦਾਰਾਂ ਨੇ ਬੜੀ ਹੀ ਪਸੰਦ ਕੀਤੀ ਅਤੇ ਉਹ ਉਹ ਫੋਟੋ ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਮੇਰੇ ਤੋਂ ਉਹ ਕਿੱਦਾਂ ਫੋਟੋ ਮੈਂ ਐਵੇਂ ਹੀ ਖਿੱਚ ਲਈ ਸੀਗੀ ਅਤੇ ਉਹ ਫੋਟੋ ਅੱਜ ਮਤਲਬ ਮੇਰਾ ਕੈਰੀਅਰ ਦਾ ਸਟਾਰਟਿੰਗ ਸੀਗੀ ਉਹ ਫੋਟੋ ਅਤੇ ਉੱਥੋਂ ਮੈਂ ਸੋਚਿਆ ਕਿ ਮੈਂ ਇਹ ਫੋਟੋਗ੍ਰਾਫੀ ਆਪਣਾ ਸ਼ੌਂਕ ਜਿਹੜਾ ਇਹਨੂੰ ਬਦਲ ਲੈਣਾ ਹੈ ਆਪਣੇ ਪ੍ਰੋਫੈਸ਼ਨ ਵਿੱਚ ਆਪਣੇ ਬਿਜਨਸ ਵਿੱਚ ਲੈ ਕੇ ਆਉਣਾ ਅਤੇ